ਸਤਿ ਸ਼੍ਰੀ ਅਕਾਲ ਜੀ ਭਾਰਤ ਬਹੁਤ ਹੀ ਖੂਬਸੂਰਤ ਦੇਸ਼ ਹੈ ਇੱਥੇ ਵਿਭਿੰਨ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ ਜੇਕਰ ਮੈਨੂੰ ਆਪਣੀਆਂ ਤਸਵੀਰਾਂ ਰਾਹੀਂ ਭਾਰਤ ਨੂੰ ਦਿਖਾਉਣ ਦਾ ਮੌਕਾ ਮਿਲੇ ਤਾਂ ਮੈਂ ਸਭ ਤੋਂ ਪਹਿਲਾਂ ਭਾਰਤ ਦੇ ਉੱਤਰ ਵਿੱਚ ਸਥਿਤ ਕਸ਼ਮੀਰ ਦੀਆਂ ਫੋਟੋਆਂ ਜ਼ਰੂਰ ਦਿਖਾਣਾ ਚਾਹਾਂਗੀ ਕਸ਼ਮੀਰ ਆਪਣੀ ਪ੍ਰਕਿਰਤਿਕ ਖੂਬਸੂਰਤੀ ਕਰਕੇ ਜਾਣਿਆ ਜਾਂਦਾ ਹੈ ਇਥੇ ਬਹੁਤ ਹੀ ਖੂਬਸੂਰਤ ਥਾਵਾਂ ਹਨ ਜਿਵੇਂ ਕਿ ਡੱਲ ਝੀਲ ਗੁਲਮਾਰਗ ਸੋਨਮਾਰਗ ਬਰਫ਼ ਦੇ ਨਾਲ ਢਕੇ ਹੋਏ ਉੱਚੇ ਉੱਚੇ ਪਹਾੜ ਉੱਤਰ ਭਾਰਤ ਦੇ ਵਿੱਚ ਸਥਿਤ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ਿਮਲਾ ਅਤੇ ਮਨਾਲੀ ਜੋ ਕਿ ਆਪਣੀ ਪ੍ਰਕਿਰਤਿਕ ਖੂਬਸੂਰਤੀ ਕਰਕੇ ਹਮੇਸ਼ਾ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਹੇ ਹਨ ਉੱਥੇ ਮੈਂ ਜ਼ਰੂਰ ਫੋਟੋ ਖਿਚਵਾਉਣਾ ਚਾਹਾਂਗੀ ਭਾਰਤ ਦੇ ਉੱਤਰਾਖੰਡ ਰਾਜ ਦੇ ਵਿੱਚ ਨੈਨੀਤਾਲ ਵਿਖੇ ਨੈਨੀ ਲੇਕ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਹੁੰਦਾ ਹੈ ਉੱਥੇ ਮੈਂ ਜ਼ਰੂਰ ਫੋਟੋ ਖਿਚਵਾਉਣਾ ਚਾਹਾਂਗੀ ਇਸ ਦੇ ਨਾਲ ਹੀ ਅਸਾਮ ਦੇ ਵਿੱਚ ਬਹੁਤ ਹੀ ਪ੍ਰਕਿਰਤਿਕ ਖੂਬਸੂਰਤੀ ਪਾਈ ਜਾਂਦੀ ਹੈ ਉੱਥੇ ਚਾਹ ਤੇ ਬਾਗ ਅਤੇ ਔਰੰਗ ਨੈਸ਼ਨਲ ਪਾਰਕ ਬਹੁਤ ਹੀ ਮਸ਼ਹੂਰ ਹਨ ਉੱਥੇ ਮੈਂ ਜ਼ਰੂਰ ਫੋਟੋ ਖਿਚਵਾਉਣਾ ਚਾਹਾਂਗੀ ਭਾਰਤ ਦੇ ਦੱਖਣ ਦੇ ਵਿੱਚ ਸਥਿਤ ਕੇਰਲ ਅਤੇ ਤਮਿਲਨਾਡੂ ਆਪਣੀ ਪ੍ਰਕਿਰਤਿਕ ਖੂਬਸੂਰਤੀ ਕਰਕੇ ਬਹੁਤ ਹੀ ਮਸ਼ਹੂਰ ਹਨ ਕੇਰਲ ਰਾਜ ਦੇ ਵਿੱਚ ਮੁਨਾਰ ਅਤੇ ਕੋਚੀ ਵਰਗੀਆਂ ਥਾਵਾਂ ਬਹੁਤ ਹੀ ਖੂਬਸੂਰਤ ਹਨ ਇਸ ਦੇ ਨਾਲ ਹੀ ਕੇਰਲ ਦੇ ਵਿੱਚ ਬਹੁਤ ਸਾਰੀਆਂ ਬੀਚਸ ਵੀ ਹਨ ਜਿੱਥੇ ਮੈਂ ਜ਼ਰੂਰ ਫੋਟੋ ਖਿਚਵਾਉਣਾ ਚਾਹਾਂਗੀ ਭਾਰਤ ਦੇ ਤਾਮਿਲਨਾਡੂ ਦੇ ਵਿੱਚ ਕੰਨਿਆ ਕੁਮਾਰੀ ਵਿਖੇ ਸੂਰਜ ਉੱਗਣ ਅਤੇ ਸੂਰਜ ਢਲਣ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਹੁੰਦਾ ਹੈ ਗੋਆ ਦੇ ਵਿੱਚ ਬਹੁਤ ਸਾਰੀਆਂ ਬੀਚਸ ਸਨ ਜਿਨ੍ਹਾਂ ਦੇ ਵਿੱਚੋਂ ਬਾਗਾ ਬੀਚ ਬਹੁਤ ਹੀ ਮਸ਼ਹੂਰ ਹੈ ਉੱਥੇ ਮੈਂ ਜ਼ਰੂਰ ਫੋਟੋ ਖਿਚਵਾਉਣਾ ਚਾਹਾਂਗੀ ਗੁਜਰਾਤ ਰਾਜ ਦੇ ਵਿੱਚ ਰਣ ਆਫ ਕੱਛ ਬਹੁਤ ਹੀ ਖੂਬਸੂਰਤ ਸਥਾਨ ਹੈ ਉੱਥੇ ਮੈਂ ਜ਼ਰੂਰ ਫੋਟੋ ਖਿਚਵਾਉਣਾ ਚਾਹਾਂਗੀ ਇਸ ਦੇ ਨਾਲ ਹੀ ਭਾਰਤ ਦੇ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਹਨ ਜਿਸ ਜਗ੍ਹਾ 'ਤੇ ਮੈਂ ਜ਼ਰੂਰ ਫੋਟੋ ਖਿਚਵਾਉਣਾ ਚਾਹਵਾਂਗੇ ਜਿਵੇਂ ਕਿ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਅਨੰਦਪੁਰ ਸਾਹਿਬ ਹੇਮਕੁੰਟ ਸਾਹਿਬ ਨਾਢਾ ਸਾਹਿਬ ਅਤੇ ਅਯੋਧਿਆ ਦਾ ਰਾਮ ਮੰਦਿਰ ਇਸ ਤੋਂ ਇਲਾਵਾ ਤਮਿਲਨਾਡੂ ਦੇ ਵਿੱਚ ਵੀ ਬਹੁਤ ਸਾਰੇ ਖੂਬਸੂਰਤ ਮੰਦਰ ਹਨ ਜੋ ਕਿ ਹਮੇਸ਼ਾ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਹੇ ਹਨ ਭਾਰਤ ਵਿਚ ਹੋਰ ਵੀ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ ਜਿੱਥੇ ਮੈਂ ਜ ਫੋਟੋ ਜ਼ਰੂਰ ਖਿਚਵਾਉਣਾ ਚਾਹਵਾਂਗੀ ਜਿਵੇਂ ਕਿ ਦਾਰਜਲਿੰਗ ਅਤੇ ਊਟੀ ਦਾਰਜਲਿੰਗ ਅਤੇ ਊਟੀ ਦੇ ਵਿੱਚ ਬਹੁਤ ਹੀ ਖੂਬਸੂਰਤ ਪਹਾੜ ਹਨ ਜਿਨ੍ਹਾਂ ਦੇ ਉੱਤੇ ਟਰੈਕਿੰਗ ਕੀਤੀ ਜਾਂਦੀ ਹੈ ਜਿੱਥੇ ਘੁੰਮ ਕੇ ਬਹੁਤ ਹੀ ਚੰਗਾ ਲੱਗਦਾ ਹੈ ਅਤੇ ਮਨ ਨੂੰ ਸਕੂਨ ਮਿਲਦਾ ਹੈ ਧੰਨਵਾਦ